ਭਾਰਤ ਵਿੱਚ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ ਜ਼ਿਆਦਾ ਸਕੂਟਰਾਂ ਮੋਟਰਸਾਈਕਲ ਵਹੀਕਲ ਹੋਣ ਕਰਕੇ ਅਤੇ ਗੱਡੀਆਂ ਵੀ ਜਿਸ ਕਾਰਨ ਲੋਕ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਗ੍ਹਾ ਜਾਣ ਲਈ ਵਹੀਕਲ ਹੀ ਚੱਕ ਲੈਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਜੋ ਕਿ ਸਾਨੂੰ ਸਾਹ ਲੈਣ ਵਿੱਚ ਬਹੁਤ ਦਿੱਕਤ ਦਿੰਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਨਾਲ ਕਨੋਇਸ ਪਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਧਰਤੀ ਬਹੁਤ ਗਰਮ ਹੁੰਦੀ ਹੈ ਜਿਸ ਕਾਰਨ ਪਲਿਊਸ਼ਨ ਹੁੰਦਾ ਹੈ ਅਤੇ ਪੋਲਿਊਸ਼ਨ ਨਾਲ ਕਈ ਪੰਛੀਆਂ ਦੀ ਪ੍ਰਜਾਤੀਆਂ ਵੀ ਖਤਮ ਹੋ ਗਈਆਂ ਹਨ ਅਤੇ ਸਾ ਸਾਨੂੰ ਕਿਤੇ ਵੀ ਆਵਾਜਾਈ ਜਾਣਾ ਕਿਤੇ ਵੀ ਜਾਣਾ ਹੋਵੇ ਆਵਾਜਾਈ ਇੰਨੀ ਕੁ ਵੱਧ ਗਈ ਹੈ ਕਿਤੇ ਵੀ ਟਾਈਮ 'ਤੇ ਪਹੁੰਚਿਆ ਹੀ ਨਹੀਂ ਜਾ ਸਕਦਾ ਅਤੇ ਥੈਂਕ ਯੂ ਧੰਨਵਾਦ